ਅੱਠ ਅਪ੍ਰੈਲ ਦੋ ਹਜ਼ਾਰ ਪੰਜ ਉੱਨੀ ਅਗਸਤ ਦੋ ਹਜ਼ਾਰ ਅੱਠ ਪੱਚੀ ਮਈ ਉੱਨੀ ਸੌ ਉੱਨੀ ਸੱਤ ਜੁਲਾਈ ਦੋ ਹਜ਼ਾਰ ਛੇ ਬਾਰ੍ਹਾਂ ਜਨਵਰੀ ਦੋ ਹਜ਼ਾਰ ਸੋਲ੍ਹਾਂ